ਮੈਂ ਆਪਣੇ ਕਿਰਦਾਰਾਂ ਦਾ ਵਿਕਾਸ ਅਖ਼ਬਾਰਾਂ ਅਤੇ ਹੋਰ ਧਾਰਮਿਕ ਕਿਤਾਬਾਂ ਤੋਂ ਕਰਦਾ ਹਾਂ ਜਿਸ ਤਰ੍ਹਾਂ ਅਖ਼ਬਾਰਾਂ ਵਿੱਚ ਲੇਖ ਕਿਸੇ ਖ਼ਾਸ ਕਿਸੇ ਗਾ ਖ਼ਾਸ ਤਿਉਹਾਰ 'ਤੇ ਲੇਖ ਵ ਛਪਦੇ ਹਨ ਅਤੇ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਦਾ ਹਾਂ ਅਤੇ ਉਹਨਾਂ ਤੋਂ ਚੰਗੀਆਂ ਗੱਲਾਂ ਨੋਟ ਕਰਕੇ ਵੱਖਰੀਆਂ ਵੱਖਰੀਆਂ ਪੇਪਰ 'ਤੇ ਲਿਖਦਾ ਹਾਂ ਅਤੇ ਉਹ ਉਹਨਾਂ ਨੂੰ ਆਪਣਾ ਯਾਦ ਕਰ ਯਾਦ ਕਰਦਾ ਹਾਂ ਅਤੇ ਮੇਰੇ ਕੋਲ ਕੋਈ ਦਿਲਚਸਪ ਅੱਖਰ ਬਣਾਉਣ ਲਈ ਵੀ ਖ਼ਾਸ ਪ੍ਰਕਿਰਿਆ ਹੈ ਮੈਂ ਆਪਣੇ ਯਾਰਾਂ ਦੋਸਤਾਂ ਦੇ ਜਾਂ ਬੱਚਿਆਂ ਦੇ ਨਿੱਕਨੇਮ ਰੱਖੇ ਹੋਏ ਹਨ ਜਿਹੜੇ ਕਿ ਉਹ ਵੀ ਉਹਨਾਂ ਨੂੰ ਸੁਣ ਕੇ ਖੁਸ਼ੀ ਹੁੰਦੀ ਹੈ ਅਤੇ ਉਹ ਉਹ ਆਪ ਉਹ ਆਪਣਾ ਇਸ ਨਾਲ ਆਪਣੀ ਆਪਣੀ ਅਸਲੀਅਤ ਸਮਝਦੇ ਹਨ ਅਤੇ ਮੈਂ ਇਹ ਇਹ ਮੈਨੂੰ ਬੜਾ ਸ਼ੌਕ ਹੈਗਾ ਹੈ ਅਤੇ ਮੈਂ ਅਪਜਾ ਅਪਮਾਨਜਨਕ ਗੱਲਾਂ ਨਹੀਂ ਲਿਖਦਾ ਅਤੇ ਨਾ ਹੀ ਇਹਨਾਂ ਨੂੰ ਆਪਣੇ ਦਿਲ ਵਿੱਚ ਲਿਆਉਂਦਾ ਹਾਂ